ਹਾਂ ਇੱਕ ਵਾਰੀ ਸਾਡੇ ਸ਼ਹਿਰ ਦੇ ਵਿੱਚ ਨਾ ਕਰਵਾਈ ਸੀ ਅਤੇ ਮੈਰਾਥੋਨ ਅਤੇ ਉਹ ਇੱਕੀ ਕਿਲੋਮੀਟਰ ਦੀ ਕਰਵਾਈ ਸੀ ਉਹਦੇ 'ਚ ਮੈਂ ਵੀ ਹਿੱਸਾ ਲਿਆ ਸੀਗਾ ਅਤੇ ਮੈਂ ਵੀ ਸੀ ਅਤੇ ਮੇਰੇ ਦੋਸਤ ਮਿੱਤਰ ਵੀ ਸੀ ਸਾਰੇ ਅਤੇ ਹਾਫ ਮੈਰਾਥੋਨ ਕਰਵਾਇਆ ਸੀਗਾ ਕਿਸੇ ਨੇ ਉੱਥੇ ਸਾਰਿਆਂ ਨੇ ਹਿੱਸੇ ਲਏ ਸੀਗੇ ਅਤੇ ਇੱਕੀ ਕਿਲੋਮੀਟਰ ਦੀ ਕਰਵਾਈ ਸੀ ਅਤੇ ਉਹਦੇ ਵਿੱਚ ਮੈਂ ਲੋਅਰ ਟੀ ਸ਼ਰਟ ਅਤੇ ਸੂਜ ਵੀ ਪਹਿਨੇ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਅਤੇ ਇਹ ਜਿਹੜੀ ਹਾਫ ਮੈਰਾਥੋਨ ਨਾ ਇਸ ਸਾਰਿਆਂ ਵਿੱਚ ਹਿੱਸਾ ਇੱਕ ਵਾਰੀ ਲੈ ਕੇ ਇਹਦੇ ਨਾਲ ਸਰੀਰ ਦੀ ਫਿਟਨੈਸ ਵੀ ਵਧੀਆ ਰਹਿੰਦੀ ਹੈ ਅਤੇ ਭਾਵ ਸਰੀਰ ਦੇ ਵਿੱਚ ਜਿਹੜੀ ਗੰਦਗੀ ਹੈ ਉਹ ਮੁੜ ਕੇ ਨਹੀਂ ਬਾਹਰ ਜਾਂਦੀ ਹੈ ਅਤੇ ਬਹੁਤ ਵਧੀਆ ਸੀ ਅਤੇ ਇਹ ਇੱਕ ਵਾਰੀ ਸਾਰਿਆਂ ਨੂੰ ਕਰਕੇ ਵੇਖਣਾ ਚਾਹੀਦਾ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਵੀ ਵੈਸੇ ਵੀ ਦੌੜਨ ਦਾ ਬਹੁਤ ਸੌਂਕ ਹੈ ਮੈਨੂੰ ਅਤੇ ਸ਼ੌਕੀਨ ਹਾਂ ਮੈਂ ਬਹੁਤ ਦੋੜਨ ਦਾ ਅਤੇ ਸਵੇਰੇ ਹੁਣ ਵੀ ਮੈਂ ਰੋਜ਼ਾਨਾ ਰਨਿੰਗ ਕਰਦਾ ਹੈਗਾ ਸ਼ਾਮ ਨੂੰ ਵੀ ਸਵੇਰੇ ਵੀ ਅਤੇ ਧੰਨਵਾਦ